ਹੈਲੋ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਜੀ ਸਟੇਸ਼ਨ ਮਾਸਟਰ ਰਾਕੇਸ਼ ਕੁਮਾਰ ਪਠਾਨਕੋਟ ਤੋਂ ਜੀ ਜ਼ਰੂਰ ਜ਼ਰੂਰ ਠੀਕ ਹੈ ਜੀ ਆਪਣੇ ਇੱਥੋਂ ਪਠਾਨਕੋਟ ਤੋਂ ਟ੍ਰੇਨਾਂ ਜਿੱਦਾਂ ਜਲੰਧਰ ਨੂੰ ਅੰਮ੍ਰਿਤਸਰ ਨੂੰ ਲੁਧਿਆਣੇ ਜੰਮੂ ਕਟੜਾ ਅਤੇ ਜੇਕਰ ਤੁਸੀਂ ਜਿੱਦਾਂ ਕਿਤੇ ਘੁੰਮਣ ਘਾਮਣ ਦਾ ਤੁਹਾਡਾ ਪਲਾਨ ਹੈ ਤਾਂ ਇੱਕ ਟ੍ਰੇਨ ਸਾਡੇ ਇੱਥੇ ਨਵੀਂ ਚੱਲੀ ਆ ਉਹਦਾ ਅੱਜ ਕੱਲ੍ਹ ਪਠਾਨਕੋਟ ਸਟੋਪ ਹੈ ਉਹਦਾ ਨਾਂ ਆ ਬੰਦੇ ਭਾਰਤ ਜੇਕਰ ਤੁਸੀਂ ਕੋਈ ਜਿੱਦਾਂ ਬੁਕਿੰਗ ਵਗੈਰਾ ਕਰਾਉਣਾ ਚਾਹੁੰਦੇ ਤਾਂ ਉਹਦੀ ਔਨਲਾਈਨ ਬੁਕਿੰਗ ਵੀ ਹੋ ਜਾਂਦੀ ਏ ਤੁਹਾਡੇ ਵਾਸਤੇ ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਰਹੇਗੀ ਉਹ ਹਾਂਜੀ ਹਾਂਜੀ ਹਾਂਜੀ ਟਾਈਮ ਉਹਦਾ ਜੀ ਮੰਗਲਵਾਰ ਸਾਢੇ ਬਾਰ੍ਹਾਂ ਵਜੇ ਸੀ ਸੀਟ ਸੀਟ ਅਰਾਮ ਨਾਲ ਮਿਲ ਜਾਣੀ ਉਹਦੀ ਟੈਂਸ਼ਨ ਕੋਈ ਨਹੀਂ ਸੀਟ ਮਿਲ ਜਾਏਗੀ ਤੁਹਾਨੂੰ ਬਹੁਤ ਅੱਛੀ

ਠੀਕ ਹੈ ਠੀਕ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਕਰੋ ਜ਼ਰੂਰ ਓਕੇ ਜੀ ਓਕੇ ਓਕੇ ਜੀ ਓਕੇ